ਲਿਖਤ ਲਈ ਵਿਚਾਰਾਂ ਦਾ ਆਉਣਾ ਕਦੇ ਤਾਂ ਸੁਭਾਵਿਕ ਹੋ ਜਾਂਦਾ ਅਤੇ ਕਦੇ ਅਸੀਂ ਖੁਦ ਚਾਹੁੰਦੇ ਹਾਂ ਕਿ ਉਸ ਬਾਰੇ ਅਸੀਂ ਕੁਛ ਸੋਚੀਏ ਅਸੀਂ ਜਿਵੇਂ ਮੇਰੀ ਲਿਖਣ ਦੀ ਪ੍ਰੇਰਨਾ ਇਹ ਹੁੰਦੀ ਹੈ ਕਿ ਮੈਂ ਸਭ ਤੋਂ ਪਹਿਲਾਂ ਕਿਤੇ ਨਾ ਕਿਤੇ ਇਸ ਇੱਕ ਇਹੋ ਜਿਹੇ ਮਾਹੌਲ 'ਚ ਬਹਿਣਾ ਹੈ ਕਿ ਜਿੱਥੇ ਮੈਨੂੰ ਪ੍ਰੇਰਨਾ ਮਿਲੇ ਕਿ ਮੈਂ ਕੁਛ ਲਿਖ ਸਕਾਂ ਜਾਂ ਮੈਂ ਕੁਛ ਸੋਚ ਸਕਾਂ ਉਸ ਤੋਂ ਬਾਅਦ ਕਈ ਵਾਰ ਐਵੇਂ ਵੀ ਹੋ ਜਾਂਦਾ ਕਿ ਅੱਖਾਂ ਅੱਗੇ ਇਹੋ ਜਿਹਾ ਦ੍ਰਿਸ਼ ਆ ਜਾਂਦਾ ਜਿਸ ਨਾਲ ਮਨ ਵਿੱਚ ਖੁਦ ਹੀ ਇੱਕ ਕਲਾਤਮਾਕ ਕਹਿ ਦੇਈਏ ਆਪਾਂ ਇੱਕ ਸੰਵੇਦਨਾ ਜਾਂ ਖੜੀ ਹੁੰਦੀ ਹੈ ਕਿ ਇਸ ਬਾਰੇ ਜਾਂ ਇਸ ਟੋਪਿਕ 'ਤੇ ਜਾਂ ਇਸ ਟਾਈਟਲ 'ਤੇ ਕੁਛ ਨਾ ਕੁਛ ਲਿਖੀਏ ਫਿਰ ਮੈਂ ਘਰ ਆ ਕੇ ਉਸ ਟਾਈਟਲ 'ਤੇ ਸੋਚਦਾ ਉਹਦੇ ਬਾਰੇ ਵਿਚਾਰ ਕਰਦਾ ਉਹਦੇ ਬਾਰੇ ਕੁਛ ਨਾ ਕੁਛ ਪੜ੍ਹਦਾ ਕਿ ਜਿਵੇਂ ਇੱਕ ਵਾਰ ਮੈਨੂੰ ਬਸ 'ਚ ਇੱਕ ਛੋਟੀ ਜਿਹੀ ਬੱਚੀ ਬੈਗ ਟੰਗੀ ਹੋਈ ਇਕੱਲੀ ਮਿਲੀ ਅਤੇ ਉਹ ਪੰਦਰਾਂ ਤੋਂ ਵੀਹ ਕਿਲੋਮੀਟਰ ਸਿਰਫ਼ ਇੱਕ ਪਿੰਡ 'ਚ ਪੜ੍ਹਨ ਆ ਰਹੀ ਸੀ ਮੈਂ ਸੋਚਿਆ ਕਿ ਉਸ ਵਿਚਾਰੀ ਕੁੜੀ ਦਾ ਕੀ ਬਚਪਨ ਬੀਤਿਆ ਹੋਣਾ ਕਿ ਉਸ ਦੀ ਕੀ ਮਜਬੂਰੀਆਂ ਉਸ ਮਾਂ ਪਿਓ ਦੀਆਂ ਕੀ ਮਜਬੂਰੀਆਂ ਹੋਣੀਆਂ ਨੇ ਕਿ ਉਹ ਆਪਣੀ ਛੋਟੀ ਜਿਹੀ ਨਿੱਕੀ ਜਿਹੀ ਕੁੜੀ ਨੂੰ ਇਕੱਲੇ ਪੜ੍ਹਨ ਲਈ ਭੇਜ ਰਹੇ ਹਨ ਉਹਦੇ ਉੱਤੇ ਉਹਦੀ ਮਾਸੂਮੀਅਤ ਉੱਤੇ ਉਹਦੀ ਬਚਪਨ ਉੱਤੇ ਮੈਂ ਇੱਕ ਕਵਿਤਾ ਲਿਖੀ ਇਸ ਕਰਕੇ ਹੀ ਹਮੇਸ਼ਾ ਮੈਂ ਆਪਣੇ ਨਾਲ ਇੱਕ ਪੈਨ ਅਤੇ ਇੱਕ ਕਾਗਜ਼ ਜ਼ਰੂਰ ਰੱਖਦਾ ਬਾਕੀ ਪ੍ਰੇਰਿਤ ਕਰਨ ਵਾਲੀ ਚੀਜ਼ ਹਮੇਸ਼ਾ ਕੋਈ ਨਾ ਕੋਈ ਟੋਪਿਕ ਹੁੰਦੀ ਹੈ ਜਿਵੇਂ ਉਸ ਬੱਚੀ ਦੀ ਬਚਪਨ ਨੇ ਉਸ ਬੱਚੀ ਦੇ ਮਾਸੂਮੀਅਤ ਨੇ ਉਸ ਬੱਚੀ ਦੀ ਪ੍ਰੇਰਨਾ ਨੇ ਕਿ ਅਸੀਂ ਪੜ੍ਹਨਾ ਹੈ ਉਸਨੇ ਮੈਨੂੰ ਬਹੁਤ ਪ੍ਰੇਰਿਤ ਕਰਦੀ ਹੈ ਅਤੇ ਕਈ ਵਾਰ ਕਈ ਹੋਰ ਚੀਜ਼ਾਂ ਵੀ ਹੁੰਦੀਆਂ ਹਨ ਜਿਵੇਂ ਕਈ ਵਾਰ ਮੈਂ ਟ੍ਰੇਨ 'ਚ ਬਜ਼ੁਰਗਾਂ ਨੂੰ ਦੇਖਦਾ ਕਿ ਕਿੱਦਾਂ ਸਫ਼ਰ ਕਰ ਰਿਹਾ ਜਾਂ ਕਿਉਂ ਕਰ ਰਹੇ ਹੈ ਜਾਂ ਕਈ ਵਾਰ ਅਸੀਂ ਸੜਕ 'ਤੇ ਦੇਖਦੇ ਹਾਂ ਬਜ਼ੁਰਗ ਮਜ਼ਦੂਰੀ ਕਰ ਰਹੇ ਆ ਜਾਂ ਹਾਂ ਕਈ ਬਜ਼ੁਰਗ ਰਿਕਸ਼ਾ ਚਲਾ ਰਹੇ ਹੈ ਉਹਨਾਂ ਵੱਲ ਦੇਖ ਕੇ ਮੈਂ ਬਹੁਤ ਪ੍ਰੇਰਿਤ ਹੁੰਦਾ ਹਾਂ ਕਿ ਇਹਨਾਂ ਉੱਤੇ ਕੁਛ ਨਾ ਕੁਛ ਲਿਖਿਆ ਜਾ ਸਕੇ